ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਓਲਾ ਕੈਬ ਦੇ ਅੋਫਿਸ ਚੋਂ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਨਾ ਜੀ ਆਪਣੇ ਡਰਾਈਵਰ ਨੇ ਜੀ ਬਹੁਤ ਅੱਛੇ ਪਹਿਲਾਂ ਮੈਂ ਉਹਨਾਂ ਦੇ ਨਾਲ ਗਿਆ ਸੀਗਾ ਟਰਿੱਪ ਦੇ ਉੱਤੇ ਅਤੇ ਮੈਂ ਦੁਬਾਰਾ ਉਹਨਾਂ ਨੂੰ ਹੀ ਬੁੱਕ ਕਰਵਾਉਣਾ ਚਾਹੁੰਦਾ ਜੇ ਕਰਵਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਜੀ ਜੇ ਕਿਸੇ ਰੂਟ 'ਤੇ ਉਹ ਨਹੀਂ ਗਏ ਹੋਏ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਦਾ ਨਾਮ ਹਰਪ੍ਰੀਤ ਸਿੰਘ ਹੈ ਜੀ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅਤੇ ਸਰ ਮੈਨੂੰ ਉਹਨਾਂ ਨੂੰ ਹਾਇਰ ਕਰ ਦਿਉ ਤੁਸੀਂ ਪੱਚੀ ਤਰੀਕ ਨੂੰ ਉਹਨਾਂ ਨੂੰ ਉਹ ਮੈਨੂੰ ਚਾਹੀਦੇ ਨੇ ਹਾਂਜੀ ਹਾਂਜੀ ਹਾਂਜੀ ਸਰ ਦਿੱਲੀ ਜਾਣਾ ਜ਼ਰੂਰੀ ਜਾਣਾ ਮੇਰੇ ਬੇਟੇ ਦੀ ਉੱਥੇ ਏਰ ਏਅਰਪੋਰਟ 'ਤੇ ਮੈਂ ਉਹਨਾਂ ਨੂੰ ਲੈ ਕੇ ਜਾਣਾ ਸਮਾਨ ਛੱਡ ਕੇ ਆਉਣਾ ਉਹਨਾਂ ਨੇ ਜਾਣਾ ਉਹਨਾਂ ਦੀ ਫਲਾਈਟ ਹੈ ਠੀਕ ਹੈ ਜੀ ਉਹ ਬਹੁਤ ਅੱਛੇ ਡਰਾਇਵਰ ਨੇ ਇਸ ਕਰਕੇ ਮੈਂ ਉਹਨਾਂ ਨੂੰ ਹੀ ਬੁੱਕ ਕਰਵਾਉਣਾ ਚਾਹੁੰਦਾ ਸੋ ਪਲੀਜ਼ ਰਿਕੁਐਸਟ ਹੈ ਮੈਨੂੰ ਪੱਚੀ ਤਰੀਕ ਨੂੰ ਉਹਨਾਂ ਨੂੰ ਚਾਹੀਦੇ ਨੇ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਕੋਈ ਗੱਲ ਹੈ ਹਾਂ ਹਾਂ ਕੋਈ ਚੱਕਰ ਹੈ ਜੀ ਜਿਵੇਂ ਕਹਿਣਗੇ ਉਵੇਂ ਹੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ